ਸਭ ਤੋਂ ਅਸਧਾਰਨ ਅਤੇ ਦੁਰਲੱਭ ਪੰਛੀ ਸੁਨਹਿਰੀ ਉੱਲੂ ਹੈ ਜਿਸ ਨੂੰ ਅਸੀਂ ਬਹੁਤ ਹੀ ਕਾਫੀ ਸਮੇਂ ਬਾਅਦ ਦੂਜੇ ਪੰਛੀਆਂ ਦੇ ਨਾਲ ਦੇਖਦੇ ਹਾਂ ਜਦੋਂ ਅਸੀਂ ਇਹਨੂੰ ਦੇਖਦੇ ਹਾਂ ਤਾਂ ਇਹ ਲੁਕਣ ਦੀ ਕੋਸ਼ਿਸ਼ ਕਰਦਾ ਹੈ ਅਤੇ ਸਾਡੇ ਸਾਹਮਣੇ ਨਹੀਂ ਆਉਂਦਾ